ਹੈਲੋ ਹਾਂਜੀ ਤੁਸੀਂ ਸਾਗਰ ਰਤਨਾ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਸਰ ਮੈਂ ਤੁਹਾਡੀ ਰੈਗੂਲਰ ਕਸਟਮਰ ਗੱਲ ਕਰ ਰਹੀ ਹਾਂ ਤੁਹਾਡੇ ਤੋਂ ਹੀ ਆਰਡਰ ਕਰੀਦਾ ਅਸੀਂ ਕੋਈ ਵੀ ਪਾਰਟੀ ਹੁੰਦੀ ਆ ਹੁਣ ਸਾਡੇ ਘਰ ਸਰ ਥੋੜ੍ਹੇ ਜਿਹੇ ਮਹਿਮਾਨ ਆਏ ਹੋਏ ਨੇ ਤਾਂ ਮੈਂ ਪਹਿਲਾਂ ਤੁਹਾਡੇ ਰੈਸਟੋਰੈਂਟ 'ਚ ਆਰਡਰ ਕੀਤਾ ਹੋਇਆ ਗਾ ਸਰ ਹੁਣ ਮੈਂ ਨਾਲ ਨਾ ਸੋਫਟ ਡਰਿੰਕਸ ਵੀ ਆਰਡਰ ਕਰਨੀਆਂ ਸੀਗੀਆਂ ਤਾਂ ਨਾਲ ਉਹਦੇ ਤੁਸੀਂ ਦੇਖ ਲਓ ਸਲਾਈਸ ਹੋ ਗਿਆ ਮਾਜ਼ਾ ਫੈਂਟਾ ਕੋਕ ਮਤਲਬ ਤੁਸੀਂ ਦੇਖ ਲਓ ਜਿਹੜੀਆਂ ਵੀ ਤੁਹਾਡੇ ਇੱਥੇ ਅਵੇਲੇਬਲ ਹੋਣੀਆਂ ਜਿਹੜਾ ਵੀ ਅਸੀਂ ਆਰਡਰ ਕੀਤਾ ਸੀਗਾ ਨਾ ਉਹਦੇ ਨਾਲ ਤੁਸੀਂ ਇੱਕ ਇੱਕ ਕਰ ਦਿਉ ਸ਼ਾਇਦ ਤੁਸੀਂ ਮੈਨੂੰ ਲੱਗਦਾ ਪੀਜ਼ਾ ਦੇ ਪੰਦਰ੍ਹਾਂ ਬਾਕਸਿਜ਼ ਕਹੇ ਸੀਗੇ ਤਾਂ ਨਾਲ ਤੁਸੀਂ ਇਦਾਂ ਕਰੋ ਪੰਦਰਾਂ ਬੋਟਲਜ਼ ਐਡ ਕਰ ਦਿਉ ਪੰਦਰ੍ਹਾਂ ਬੋਟਲ ਸਰ ਉਹ ਤੁਸੀਂ ਚੈੱਕ ਕਰ ਲਿਓ ਕਿਉਂਕਿ ਮਤਲਬ ਬੈਠੇ ਹੀ ਹੋਏ ਨੇ ਸਾਰੇ ਤਾਂ ਆਲਰੇਡੀ ਅਸੀਂ ਕਾਫੀ ਲੇਟ ਹਾਂ ਤਾਂ ਮਤਲਬ ਠੰਡਾ ਹੀ ਹੋਵੇ ਤੁਸੀਂ ਚੈੱਕ ਕਰ ਲਿਓ ਬਾਕੀ ਸਰ ਪੇਮੈਂਟ ਉਹ ਮੈਂ ਦੇਖ ਰਹੀ ਹਾਂ ਕਿ ਮੈਂ ਕੈਸ਼ ਓਨ ਡਿਲੀਵਰੀ ਕਰਾਂ ਤੁਸੀਂ ਮਤਲਬ ਮੈਨੂੰ ਦੱਸ ਸਕਦੇ ਹੋ ਵੀ ਤੁਸੀਂ ਕਿੰਨੇ ਵਜੇ ਤੱਕ ਤੁਹਾਡਾ ਹੋ ਜਾਏਗਾ ਫਾਈਨਲ ਬਾਕੀ ਮੈਂ ਦੇਖ ਲੈਂਦੀ ਹਾਂ ਚਲੋ ਹੈਲੋ